ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਗਿਆ ਕਿ ਮੈਨੂੰ ਗਾਉਣ ਦਾ ਬਹੁਤ ਹੀ ਚਾਹ ਹੁੰਦਾ ਤੇ ਮੈਨੂੰ ਅੱਜ ਇਹ ਦੱਸਦਿਆਂ ਬੜਾ ਈ ਮਾਣ ਮਹਿਸੂਸ ਹੋ ਰਿਹਾ ਮੇਰੀ ਬੜੀ ਖੂਬਸੂਰਤੀ ਯਾਦਗਾਰ ਏ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆਂ ਮੈਨੂੰ ਯਾਦ ਐ ਜਦੋਂ ਕਿ ਮੈਂ ਸਕੂਲ ਵਿੱਚ ਪੜ੍ਹਦੀ ਹੁੰਦੀ ਸੀ ਤੇ ਮੈਨੂੰ ਗਾਉਣ ਦਾ ਸ਼ੌਂਕ ਸੀ ਤੇ ਸਾਡੇ ਸਕੂਲ ਵਿੱਚ ਸਲਾਨਾ ਫੰਕਸ਼ਨ ਮਨਾਇਆ ਜਾ ਰਿਹਾ ਸੀਗਾ ਤੇ ਮੈਨੂੰ ਮੇਰੇ ਅਧਿਆਪਕ ਨੇ ਕਿਹਾ ਕਿ ਤੁਸੀਂ ਨਾ ਪਾਰਟੀਸਪੇਟ ਕਰਨਾ ਹੈ ਗਾਣੇ ਦੇ ਵਿੱਚ ਤੇ ਮੈਂ ਇੱਕ ਵਾਰ ਤਾਂ ਮੈਂ ਬਹੁਤ ਖੁਸ਼ ਹੋਈ ਪਰ ਮੈਨੂੰ ਸਟੇਜ ਦਾ ਬਹੁਤ ਡਰ ਐ ਮੈਨੂੰ ਮਤਲਬ ਜਿਆਦਾ ਲੋਕਾਂ ਦੇ ਵਿੱਚ ਗਾਉਣ ਦੇ ਵਿੱਚ ਥੋੜੀ ਝੀਜਕ ਜਿਹੀ ਮਹਿਸੂਸ ਹੁੰਦੀ ਐ ਪਰ ਮੈਂ ਫਿਰ ਵੀ ਆਪਣੀ ਹਿੰਮਤ ਕੀਤੀ ਮੈਨੂੰ ਮੇਰੇ ਅਧਿਆਪਕ ਨੇ ਵੀ ਥੋੜਾ ਹੌਸਲਾ ਦਿੱਤਾ ਕਿ ਇੱਕ ਵਾਰ ਕਰਨ ਨਾਲ ਕਿ ਤੁਹਾਡੇ ਵਿੱਚ ਕੋਨਫੀਡੈਂਸ ਆ ਜਾਂਦਾ ਤਾਂ ਮੈਂ ਵਾਹਿਗੁਰੂ ਜੀ ਦਾ ਨਾਮ ਲਿਤਾ ਤੇ ਮੈਂ ਸਟੇਜ ਤੇ ਗਾਉਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਮੈਂ ਗਾਣਾ ਗਾਲਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਸਾਰਿਆਂ ਨੇ ਮੈਨੂੰ ਖੜ ਕੇ ਮੇਰੇ ਲਈ ਤਾੜੀਆਂ ਮਾਰੀਆਂ ਤੇ ਉਹ ਦਿਨ ਮੇਰੇ ਲਈ ਇਨਾ ਕੁ ਵਧੀਆ ਸੀ ਮੈਨੂੰ ਇੰਨੀ ਖੁਸ਼ੀ ਮਹਿਸੂਸ ਹੋਈ ਤੇ ਜਿਹੜਾ ਮੇਰਾ ਸਟੇਜ ਦਾ ਡਰ ਸੀ ਉਹ ਵੀ ਮੇਰੇ ਅੰਦਰੋਂ ਨਿਕਲ ਗਿਆ ਤੇ ਸਭ ਨੇ ਮੇਰੇ ਆਵਾਜ਼ ਦੀ ਤਾਰੀਫ ਕੀਤੀ ਤੇ ਮੇਰੇ ਅੱਖਾਂ ਵਿੱਚ ਉਦਣ ਖੁਸ਼ੀ ਵਾਲੇ ਹੰਜੂ ਸੀ ਤੇ ਮੇਰੇ ਅਧਿਆਪਕ ਵੀ ਮੇਰੇ ਤੇ ਇਹਨਾਂ ਮਾਣ ਮਹਿਸੂਸ ਕਰ ਰਹੇ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕੀ ਤੈਨੂੰ ਇਹ ਇਸ ਫੀਲਡ ਵਿੱਚ ਜਾਣਾ ਚਾਹੀਦਾ ਐ ਇਹਨੂੰ ਆਪਣਾ ਜਿਹੜਾ ਹੁਨਰ ਐ ਉਹ ਤੈਨੂੰ ਅੱਗੇ ਲਿਆਉਣਾ ਚਾਹੀਦਾ ਐ ਤੇ ਇਹ ਮੇਰੇ ਲਈ ਬਹੁਤ ਹੀ ਬਹੁਤ ਹੀ ਖੂਬਸੂਰਤ ਇਕ ਯਾਦਗਾਰ ਹੈ ਜੋ ਮੈਨੂੰ ਹਮੇਸ਼ਾ ਵੀ ਯਾਦ ਰਹਿੰਦੀ ਹੈ ਮਤਲਬ ਕਿ ਅੱਜ ਵੀ ਜਦੋਂ ਮੈਂ ਮਤਲਬ ਕਿ ਇਸ ਯਾਦਗਾਰ ਨੂੰ ਕਿਸੇ ਨਾਲ ਸਾਂਝੀ ਕਰਦੀ ਆਂ ਜਾਂ ਜਦ ਵੀ ਮੈਨੂੰ ਇਹ ਯਾਦ ਆ ਜਾਂਦੀ ਹੈ ਤਾਂ ਮੇਰੇ ਅੱਜ ਵੀ ਖੁਸ਼ੀ ਵਾਲੇ ਹੰਜੂ ਅੱਖਾਂ ਵਿੱਚ ਆ ਜਾਂਦੇ ਹਨ ਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਐ ਧੰਨਵਾਦ ਜੀ ਤੁਸੀਂ ਮੈਨੂੰ ਅੱਜ ਫਿਰ ਤੋਂ ਇਹ ਖੂਬਸੂਰਤ ਯਾਦਗਾਰ ਜਿਹੜੀ ਤੁਸੀਂ ਮੈਨੂੰ ਅੱਜ ਫਿਰ ਤੋਂ ਯਾਦ ਦਵਾਈ ਏ ਧੰਨਵਾਦ ਜੀ